ਹੈਲੋ ਵੀਰੇ ਆਪਾਂ ਨੂੰ ਸੜਕ ਖ਼ਰਾਬ ਹੋਣ ਕਰਕੇ ਰਸਤਾ ਚੇਂਜ ਕਰਨਾ ਪਿਆ ਹੈ ਨਾ ਅਤੇ ਪਹਿਲਾਂ ਤਾਂ ਇਹ ਸੜਕ ਵ ਕਾਫ਼ੀ ਵਧੀਆ ਸੀਗੀ ਅਤੇ ਹੁਣ ਇਹ ਖ਼ਰਾਬ ਹੋ ਗਈ ਹੈ ਅਤੇ ਅੱਜ ਆਪਾਂ ਨੂੰ ਨਵੇਂ ਰਸਤੇ ਵਿੱਚ ਦੀ ਜਾਣਾ ਪਿਆ ਜੋ ਕਿ ਕਾਫ਼ੀ ਵਧੀਆ ਅਤੇ ਜਿਹੜੇ ਆਪਾਂ ਰਸਤੇ ਪਹਿਲਾਂ ਜਾਂਦੇ ਸੀ ਉਹ ਓੱਥੋਂ ਤਾਂ ਟਾਈਮ ਬਹੁਤ ਜ਼ਿਆਦਾ ਘੱਟ ਹੀ ਲੱਗਦਾ ਸੀ ਘਰ ਮੈਨੂੰ ਪਹੁੰਚਣ ਤੱਕ ਮਸਾਂ ਕੁ ਵੀਹ ਕੁ ਮਿੰਟ ਤੱਕ ਲੱਗਦੇ ਸੀਗੇ ਅਤੇ ਉਹ ਅੱਜ ਆਪਾਂ ਰਸਤੇ ਨਵੇਂ ਰਸਤੇ ਵਿੱਚ ਦੀ ਜਾ ਰਹੇ ਹਾਂ ਜਿਸ ਵਿੱਚ ਦੀ ਕਾਫ਼ੀ ਟਾਈਮ ਲੱਗ ਰਿਹਾ ਹੈ ਨਾ ਕਿ ਜ਼ਿਆਦਾ ਹੀ ਘੁੰਮਾ ਫਿਰਾ ਕੇ ਆ ਰਿਹਾ ਗਾ ਅਤੇ ਬਹੁਤ ਹੀ ਜ਼ਿਆਦਾ ਮੋੜ ਮੋੜ ਵਗੈਰਾ ਆ ਰਹੇ ਆ ਅਤੇ ਇੱਥੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿੰਨਾ ਕੁ ਜ਼ਿਆਦਾ ਟੈਮ ਲੱਗੂਗਾ ਹੈ ਨਾ ਕਿ ਮੈਂ ਥੋੜ੍ਹਾ ਜਿਹਾ ਘਰ ਵੀ ਜਲਦੀ ਜਾਣਾ ਤੁਸੀਂ ਮੈਨੂੰ ਜਲਦੀ ਪਹੁੰਚਾ ਸਕਦੇ ਹੋ ਅਤੇ ਘਰ ਮੈਨੂੰ ਵਾਰ ਵਾਰ ਕੋਲ ਆ ਰਿਹਾ ਹੈ ਨਾ ਅਤੇ ਮੈਂ ਜਲਦੀ ਜਾਣਾ ਤੁਸੀਂ ਮੈਨੂੰ ਮੈਨੂੰ ਦੂਸਰੇ ਟੈਮ ਦੇ ਹਿਸਾਬ ਨਾਲ ਦੱਸ ਸਕਦੇ ਹੋ ਕਿ ਕਿੰਨਾ ਕੁ ਟੈਮ ਲੱਗੂਗਾ ਹੈ ਨਾ ਘਰ ਪਹੁੰਚਣ ਤੱਕ ਅ ਅਤੇ ਅ ਪਹਿਲਾਂ ਤਾਂ ਵੀਹ ਕ ਮਿੰਟ ਹੀ ਲੱਗਦੇ ਸੀ ਮਸਾਂ ਅਤੇ ਹੁਣ ਨਵੇਂ ਰਸਤੇ ਦੇ ਕਾਰਨ ਕੁਛ ਜ਼ਿਆਦਾ ਟੈਮ ਲੱਗੇਗਾ ਤੁਸੀਂ ਆਪ ਮਾੜਾ ਜਿਹਾ ਮੈਨੂੰ ਦੱਸ ਦਿਓ ਕਿੰਨਾ ਕੁ ਟੈਮ ਲੱਗੂ ਜੇ ਕੋਈ ਗੱਲ ਨਹੀਂ ਜੇ ਅੱਧਾ ਘੰਟਾ ਵਗੈਰਾ ਵੀ ਲੱਗੇਗਾ ਬੱਟ ਤੁਸੀਂ ਮੈਨੂੰ ਜਲਦੀ ਤੋਂ ਜਲਦੀ ਪਹੁੰਚਾ ਦਿਓ ਪਲੀਸ